ਹਾਂਜੀ ਮੇਰੇ ਕੋਲ ਪੁਰਾਣੀਆਂ ਫੋਟੋਆਂ ਦੀ ਹਾਰਡ ਕਾਪੀ ਪਈ ਹੋਈ ਹੈ ਅਤੇ ਨਵੀਆਂ ਫੋਟੋਆਂ ਦੀ ਵੀ ਪ੍ਰਿੰਟ ਪਏ ਹੋਏ ਹਨ ਨਵੀਆਂ ਔਰ ਪੁਰਾਣੀਆਂ ਫੋਟੋਆਂ ਵਿੱਚ ਭਾਵਨਾ ਦੇ ਮੁੱਲ ਨੂੰ ਲੈ ਕੇ ਪੁੱਛਿਆ ਜਾ ਰਿਹਾ ਹੈ

ਸਿਰਫ਼ ਅਤੇ ਸਿਰਫ਼ ਫ਼ਰਕ ਸਿਰਫ਼ ਇਹ ਹੋਇਆ ਹੈ ਕਿ ਉਹ ਫੋਟੋਆਂ ਜਿਹੜੀਆਂ ਨੇ ਅੱਜ ਕਲੀਅਰ ਜ਼ਿਆਦਾ ਹੋ ਗਈਆਂ ਨੇ ਪਹਿਲਾਂ ਉੰਨੀ ਕਲੈਰਟੀ ਨਹੀਂ ਹੁੰਦੀ ਸੀ ਕਿਉਂਕਿ ਉਸ ਟਾਈਮ ਉਹ ਤਕਨੀਕ ਨਹੀਂ ਮੌਜੂਦ ਸੀ ਜੋ ਤਕਨੀਕ ਹੁਣ ਮੌਜੂਦ ਆ ਅਤੇ ਡਿਜੀਟਲ ਫੋਟੋਆਂ ਔਰ ਪੁਰਾਣੀਆਂ ਫੋਟੋਆਂ ਦੇ ਵਿੱਚ ਫ਼ਰਕ ਤਾਂ ਕੁਝ ਨਹੀਂ ਹੈ ਭਾਵਨਾਤਮਕ ਫ਼ਰਕ ਕੁਝ ਨਹੀਂ ਹੈ ਕਿਉਂਕਿ ਭਾਵਨਾ ਜਿਹੜੀ ਹੈ ਉਹ ਮਨ ਨਾਲ ਜੁੜੀ ਹੁੰਦੀ ਹੈ ਉਹ ਦੇਖਣ ਵਾਲੇ ਦੇ ਅੱਖਾਂ ਵਿੱਚ ਹੁੰਦੀ ਹੈ ਕਿ ਉਹ ਕਿਸ ਭਾਵ ਨਾਲ ਫੋਟੋ ਨੂੰ ਦੇਖ ਰਿਹਾ ਹੈ ਇਸ ਲਈ ਭਾਵਨਾਤਮਕ ਮੁੱਲ ਦੋਨੋਂਆਂ ਦਾ ਦੋਨੋਂ ਫੋਟੋਆਂ ਦਾ ਬਰਾਬਰ ਹੀ ਹੈ ਪੁਰਾਣੀਆਂ ਦਾ ਵੀ ਅਤੇ ਡਿਜੀਟਲ ਫੋਟੋਆਂ ਦਾ ਵੀ ਧੰਨਵਾਦ